ਸਾਡੇ ਰਾਜ ਵਿੱਚ ਗੇਂਹੂ ਚਾਵਲ ਇਹਦੀ ਖੇਤੀ ਹੁੰਦੀ ਹੈ ਸ਼ੂਗਰਕੇਨ ਗੰਨਾ ਵੀ ਉਗਾਇਆ ਜਾਂਦਾ ਹੈ ਪੀਨਟ ਵੀ ਉਗਾਏ ਜਾਂਦੇ ਹਨ ਅਤੇ ਸਰਸੋਂ ਦੀ ਵੀ ਖੇਤੀ ਹੁੰਦੀ ਹੈ ਔਰ ਸਾਰਾ ਚੱਕਰ ਏ ਚੱਲ ਕੇ ਹੀ ਇੱਕ ਫਸਲ ਕੱਟਣ ਤੋਂ ਬਾਅਦ ਕੁੁਛ ਦੂਸਰੀ ਫਸਲ ਉਗਾਈ ਜਾਂਦੀ ਹੈ ਉਸ ਤੋਂ ਬਾਅਦ ਹੀ ਜਿਵੇਂ ਅੱਜ ਅਸੀਂ ਕਣਕ ਬੀਜੀ ਹੈ ਉਹਨੂੂੰ ਵੱਢਣ ਤੋਂ ਬਾਅਦ ਫਿਰ ਕੋਈ ਹੋਰ ਫਸਲ ਉਗਾ ਕੇ ਉਸ ਤੋਂ ਬਾਅਦ ਅਸੀਂ ਝੋਨੇ ਦੀ ਫਸਲ ਚਾਵਲ ਦੀ ਫਸਲ ਉਗਾਉਂਦੇ ਹਾਂ